ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਮ ਮੈਂ ਏਕਮ ਦਾ ਫਾਦਰ ਬੋਲਣ ਡਿਆ ਇਹ ਪ੍ਰੀਤ ਦੇ ਮਦਰ ਬੋਲਦੇ ਪਏ ਮੈਮ ਆਪਣੇ ਬੱਚੇ ਇਕੱਠੇ ਪੜ੍ਹਦੇ ਆ ਸਕੂਲ 'ਚ ਹੁਣ ਉਹਨਾਂ ਦੀ ਟੈਂਨਥ ਹੋ ਗਈ ਅਤੇ ਮੈਂ ਤੁਹਾਡੇ ਨਾਲ ਪਲੈਨ ਕਰਨਾ ਚੋ ਚਾਹੁੰਦਾ ਸੀ ਕਿ ਆਪਾਂ ਪਲੱਸ ਵੰਨ 'ਚ ਉਹਨਾਂ ਨੂੰ ਕਿਹੜੀ ਸਟਰੀਮ ਅਤੇ ਕਿਹੜੇ ਸਕੂਲ 'ਚ ਪਾਈਏ ਕੋਈ ਸੋਚਿਆ ਤੁਸੀਂ ਹਾਂਜੀ ਮੈਮ ਮੈਂ ਮ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸੋਚਿਆ ਸੀ ਕੇਡੀ ਦਾ ਮੇਰੇ ਨੌਨ ਹੈਗੇ ਉੱਥੇ ਬਟ ਫੀਸ ਇੰਨੀ ਜ਼ਿਆਦਾ ਨਹੀਂ ਹੈ ਸਕੂਲ ਵੀ ਕਾਫੀ ਵਧੀਆ ਵਾ ਅਤੇ ਐਕਟੀਵਿਟੀਜ਼ ਵੀ ਕਾਫੀ ਅੱਛੀ ਹੁੰਦੀ ਆ ਉੱਥੇ ਸਟਰੀਮਸ ਵੀ ਕਾਫੀ ਹੈਗੀਆਂ ਸਾਰੀਆਂ ਸਟਰੀਮਸ ਹੈਗੀਆਂ ਉੱਥੇ ਕੋਮਰਸ ਆਰਟਸ ਸਾਇੰਸ ਟੀਚਰਸ ਵੀ ਬੈਸਟ ਨੇ ਕਹਿੰਦੇ ਕਿ ਟੀਚਰਸ ਵੀ ਬਹੁਤ ਵਧੀਆ ਨੇ ਉੱਥੋਂ ਦੇ ਬਹੁਤ ਨਾਈਸ ਨੇ ਵੈੱਲ ਐਡੂਕੇਟਿਡ ਨੇ ਹਾਂਜੀ ਚਲੋ ਠੈਂਕ ਯੂ ਮੈਮ